ਪਿੰਡਾਂ ਵਿੱਚ ਅੰਤਰ ਭਾਈਚਾਰਕ ਲੜਾਈਆਂ ਆਮ ਜੀ ਗੱਲ ਹੈ ਸਾਡੇ ਪਿੰਡ ਵਿੱਚ ਵੀ ਕਿਸੇ ਪਰਿਵਾਰ ਦੇ ਵਿੱਚ ਇਹ ਲੜਾਈ ਬਹੁਤ ਲੰਮਾ ਸਮਾਂ ਚੱਲੀ ਆਪਸੀ ਜ਼ਮੀਨ ਜਾਇਦਾਦ ਨੂੰ ਲੈ ਕੇ ਜਦੋਂ ਦੋ ਭਰਾ ਵੱਖਰੇ ਹੁੰਦੇ ਨੇ ਤਾਂ ਇਹ ਲੜਾਈਆਂ ਆਮ ਜਿਹੀ ਗੱਲ ਹੈ ਇੱਕੋ ਮਾਂ ਦੇ ਇੱਕੋ ਪਿਓ ਦੇ ਪੁੱਤਰ ਕਦੋਂ ਇੱਕ ਦੂਜੇ ਦੇ ਜਾਨ ਤੋਂ ਵੱਧ ਦੁਸ਼ਮਣ ਬਣ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਇੰਨਾਂ ਲੰਮਾ ਸਮਾਂ ਲੜਾਈਆਂ ਚੱਲਦੀਆਂ ਨੇ ਪਰਿਵਾਰ ਦੀਆਂ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਨੇ ਕਈ ਵਾਰ ਤਾਂ ਲੜਾਈਆਂ ਇੰਨਾਂ ਜ਼ਿਆਦਾ ਵੱਧ ਜਾਂਦੀਆਂ ਨੇ ਮੈਂ ਨਿੱਜੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਲੜਾਈਆਂ ਵੇਖੀਆਂ ਨੇ ਅਤੇ ਉਹਨਾਂ ਦੇ ਬਹੁਤ ਭਿਆਨਕ ਨਤੀਜੇ ਵੀ ਵੇਖੇ ਨੇ ਕਈ ਵਾਰ ਤਾਂ ਲੜਾਈਆਂ ਇੱਥੋਂ ਤੱਕ ਪਹੁੰਚ ਜਾਂਦੀਆਂ ਨੇ ਕਿ ਭਰਾ ਭਰਾ ਦਾ ਕਤਲ ਵੀ ਕਰ ਦਿੰਦਾ ਅਤੇ ਸਾਰੀ ਉਮਰ ਠਾਣਿਆਂ ਕਚਹਿਰੀਆਂ ਦੇ ਵਿੱਚ ਲੰਘ ਜਾਂਦੀ ਹੈ ਇੱਕ ਮਰ ਜਾਂਦਾ ਅਤੇ ਦੂਜਾ ਮਰਿਆ ਤੋਂ ਵੀ ਵੱਧ ਹੋ ਜਾਂਦਾ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਖ਼ਾਸਕਰ ਪੰਜਾਬ ਦੇ ਵਿੱਚ ਇਹ ਲੜਾਈਆਂ ਆਮ ਜਿਹੀ ਗੱਲ ਹੈ ਜੇ ਤਾਂ ਘਰੇ ਬੈਠ ਕੇ ਕਿਸੇ ਗੱਲ ਦਾ ਨਿਪਟਾਰਾ ਹੋ ਜਾਵੇ ਤਾਂ ਬਹੁਤ ਵਧੀਆ ਨਹੀਂ ਤਾਂ ਭਾਈਚਾਰਕ ਸਾਂਝ ਕਦੋਂ ਖਤਮ ਹੋ ਜਾਂਦੀ ਹੈ ਕਦੋਂ ਭਾਈਚਾਰਕ ਸਾਂਝ ਇੱਕ ਜਾਨਲੇਵਾ ਰੂਪ ਧਾਰਨ ਕਰ ਲੈਂਦੀ ਹੈ ਪਤਾ ਨਹੀਂ ਲੱਗਦਾ ਇਸ ਦੇ ਬਹੁਤ ਭਿਆਨਕ ਨਤੀਜੇ ਨਿਕਲਦੇ ਨੇ ਬਹੁਤ ਹੀ ਮਾੜੇ ਨਤੀਜੇ ਨਿਕਲਦੇ ਨੇ ਕਈ ਵਾਰ ਤਾਂ ਇਹ ਲੜਾਈ ਪੀੜ੍ਹੀਆਂ ਤੱਕ ਵੀ ਚੱਲ ਜਾਂਦੀ ਹੈ ਦੋ ਤਿੰਨ ਪੀੜ੍ਹੀਆਂ ਤੱਕ ਵੀ ਲੜਾਈਆਂ ਚੱਲ ਜਾਂਦੀਆਂ ਨੇ ਰਿਜਲਟ ਬਹੁਤ ਮਾੜੇ ਹੁੰਦੇ ਨੇ ਵਾਹਿਗੁਰੂ ਕਿਰਪਾ ਕਰੇ ਸਾਰਿਆਂ 'ਤੇ ਕਦੇ ਵੀ ਦੋ ਭਰਾਵਾਂ ਵਿੱਚ ਕਦੇ ਲੜਾਈ ਨਾ ਹੋਵੇ ਧੰਨਵਾਦ